ਭਾਰਤ ਦੇਸ਼ ਸ਼ੁਰੂ ਤੋਂ ਹੀ ਇੱਕ ਮਹਾਨ ਦੇਸ਼ ਹੈ ਭਾਰਤ ਦੇਸ਼ ਨੂੰ ਪਹਿਲਾਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਇਸ ਦਾ ਕਾਰਨ ਸੀ ਇੱਥੋਂ ਇੱਥੋਂ ਦੀ ਖੁਸ਼ਹਾਲੀ ਕਿਉਂਕਿ ਭਾਰਤ ਦੇਸ਼ ਇੱਕ ਬਹੁਤ ਹੀ ਖੁਸ਼ਹਾਲ ਦੇਸ਼ ਸੀ ਇਸ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੇ ਬਾਹਰੀ ਰਾਜਿਆਂ ਦੀ ਬਾਹਰੀ ਰਾਜ ਰਾਜਿਆਂ ਦੀ ਇੱਥੇ ਇਹਦੇ ਉੱਤੇ ਪਹਿਲਾਂ ਤੋਂ ਹੀ ਅੱਖ ਸੀ ਅਤੇ ਬਹੁਤ ਹੀ ਰਾਜਿਆਂ ਨੇ ਇਹਦੇ ਉੱਤੇ ਹਮਲਾ ਕਰਕੇ ਇਹਨੂੰ ਲੁੱਟਿਆ ਵੀ ਪਰ ਸਭ ਤੋਂ ਵੱਧ ਲੁੱਟ ਬ੍ਰਿਟਿਸ਼ ਦੀ ਬ੍ਰਿ ਈਸਟ ਇੰਡੀਆ ਕੰਪਨੀ ਨੇ ਕੀਤੀ ਜਿਹੜੀ ਭਾਰਤ ਉਤੇ ਦੋ ਸੌ ਸਾਲ ਰਾਜ ਕਰਕੇ ਗਈ ਅਤੇ ਇੱਥੋਂ ਦਾ ਧਨ ਆਪਣੇ ਦੇਸ਼ ਦੋ ਸੌ ਸਾਲ ਤੱਕ ਪਹੁੰਚਾਉਂਦੀ ਰਹੀ ਭਾਰਤ ਵਿੱਚ ਬਹੁਤ ਸਾਰੇ ਧਰਮ ਇਕੱਠੇ ਰਹਿ ਰਹੇ ਹਨ ਜਿਹਨਾਂ ਦੇ ਵਿੱਚ ਮੇਨ ਹਨ ਮੁਸਲਿਮ ਅਤੇ ਹਿੰਦੂ ਇਸੇ ਚੀਜ਼ ਨੂੰ ਦੇਖਦੇ ਹੋਏ ਬ੍ਰਿਟਿਸ਼ ਇੰਡੀਆ ਕੰਪਨੀ ਨੇ ਭਾਰਤ ਨੂੰ ਇ ਇਹ ਧਰਮਾਂ ਦੇ ਵਿੱਚ ਉਲਝਾਇਆ ਅਤੇ ਇਹਨਾਂ ਨੂੰ ਆਪਸ ਵਿੱਚ ਲੜਾਇਆ ਤਾਂ ਕਿ ਉਹਨਾਂ ਉੱਤੇ ਕੋਈ ਜ਼ਿਆਦਾ ਬੋਝ ਨਾ ਆ ਸਕੇ ਅਤੇ ਉਹ ਆ ਆਸਾਨੀ ਦੇ ਨਾਲ ਆਸਾਨੀ ਦੇ ਨਾਲ ਇੱਥੋਂ ਦਾ ਧਨ ਆਪਣੇ ਦੇਸ਼ ਲਿਜਾ ਸਕਣ ਅਤੇ ਜਦੋਂ ਉੱਨੀ ਸੌ ਸੰਤਾਲੀ ਦੇ ਵਿੱਚ ਪੰਦਰਾਂ ਅਗਸਤ ਨੂੰ ਭਾਰਤ ਨੂੰ ਆਜ਼ਾਦ ਕਰ ਦਿੱਤਾ ਗਿਆ ਤਾਂ ਉਦੋਂ ਵੀ ਬ੍ਰਿਟਿਸ਼ ਦੀ ਈਸਟ ਇੰਡੀਆ ਕੰਪਨੀ ਨੇ ਜਾਂਦੇ ਜਾਂਦੇ ਭਾਰਤ ਨੂੰ ਇੱਕ ਵੱਡਾ ਧੱਕਾ ਦਿੱਤਾ ਉਹਨਾਂ ਨੇ ਭਾਰਤ ਨੂੰ ਦੋ ਭਾਗਾਂ ਵਿੱਚ ਵੰ ਵੰਡ ਦਿੱਤਾ ਇੱਕ ਬਣਿਆ ਹਿੰਦੁਸਤਾਨ ਜਿਹਨੂੰ ਆਪਾਂ ਭਾਰਤ ਕਹਿੰਦੇ ਹਾਂ ਅਤੇ ਇੱਕ ਬਣਿਆ ਪਾਕਿਸਤਾਨ ਭਾਰਤ ਦੀ ਮਾਣ ਵਾਲੀ ਗੱਲ ਇਹ ਹੈ ਕੀ ਭਾਰਤ ਹੁਣ ਮਗ ਮੰਗਲ ਉੱਤੇ ਪਹੁੰਚਣ ਵਾਲਾ ਪਹੁੰਚਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਭਾਰਤ ਦੀ ਕੁਝ ਕੁ ਸੁਤੰਤਰਤਾ ਅੰਦੋਲਨਾਂ ਦੀ ਕੁਝ ਕੁ ਬੇਮਿਸਾਲ ਨੇਤਾ ਜਿਵੇਂ ਦਾਦਾ ਭਾਈ ਨੌਰੋਜੀ ਮੋਹਨ ਦਾਸ ਕਰਮ ਚੰਦ ਗਾਂਧੀ ਚੰਦਰ ਸ਼ੇਖਰ ਆਜ਼ਾਦ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਸਰਦਾਰ ਪਟੇਲ